ਪਹਿਲੀ ਵਾਰੀ ਚਿੱਤਰਕਾਰੀ ਸ਼ੁਰੂ ਕਰਦੇ ਸਮੇਂ ਸਾਨੂੰ ਕਈ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਈ ਵਾਰੀ ਸਾਨੂੰ ਜਦੋਂ ਅਸੀਂ ਨਵਾਂ ਨਵਾਂ ਚਿੱਤਰਕਾਰੀ ਸ਼ੁਰੂ ਕਰਦੇ ਹਨ ਤਾਂ ਸਾਨੂੰ ਚੰਗੀ ਤਰ੍ਹਾਂ ਬੁਰਸ਼ ਫੜਨ ਦਾ ਨਹੀਂ ਪਤਾ ਲੱਗਦਾ ਕਿ ਬੁਰਸ਼ ਕਿੱਦਾਂ ਫੜਨਾ ਹੈ ਅਤੇ ਕਿਹੜੀ ਚੀਜ਼ ਲਈ ਕਿਹੜਾ ਬਰੱਸ਼ ਯੂਜ਼ ਹੁੰਦਾ ਹੈ ਸਾਨੂੰ ਉਸਦਾ ਵੀ ਨਹੀਂ ਪਤਾ ਚੱਲਦਾ ਅਤੇ ਕਲਰ ਦਾ ਵੀ ਕਲਰ ਦੀ ਵੀ ਸਾਨੂੰ ਚ ਪੂਰੀ ਚੰਗੀ ਤਰ੍ਹਾਂ ਜਾਣਕਾਰੀ ਨਹੀਂ ਹੁੰਦੀ ਕਿ ਕਿਸ ਕਲਰ ਨੂੰ ਕਿਸ ਜਗ੍ਹਾ 'ਤੇ ਵਰਤਣਾ ਹੈ ਅਤੇ ਅਤੇ ਕਲਰ ਨੂੰ ਮਿਕਸ ਕਰਨਾ ਅਤੇ ਕਿਸ ਕਿਸ ਕਲਰ ਨੂੰ ਮਿਕਸ ਕਰਕੇ ਬਣਾਇਆ ਜਾਂਦਾ ਹੈ ਸਾਨੂੰ ਉਸਦੀ ਵੀ ਜਾਣਕਾਰੀ ਨਹੀਂ ਹੁੰਦੀ ਬਰੱਸ਼ ਫੜਨ ਦੀ ਸਾਨੂੰ ਬਿਲਕੁਲ ਜਾਣਕਾਰੀ ਨਹੀਂ ਹੁੰਦੀ ਕਿ ਬਰੱਸ਼ ਕਿਸ ਤਰ੍ਹਾਂ ਫੜਨਾ ਹੈ ਅਤੇ ਕਿਹੜਾ ਬਰੱਸ਼ ਕਿੱਥੇ ਯੂਸ ਕਰਨਾ ਹੈ